ਸਾਡੇ ਸਮਾਜ ਵਿੱਚ ਔਰਤਾਂ ਦੀ ਭੂਮਿਕਾ ਬਦਲੀ ਹੈ ਪਰ ਕੁੱਛ ਹਲੇ ਵੀ ਕੁੱਛ ਏਰੀਆਜ਼ ਇੱਦਾਂ ਦੇ ਹੈ ਜਿੱਥੇ ਔਰਤਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ